ਹਾਂਜੀ ਭਾਅ ਜੀ ਦੱਸੋ ਅੱਛਾ ਭਾਅ ਜੀ ਕਿੱਦਾਂ ਦੇ ਮਤਲਬ ਕਰਾਉਣੇ ਸੀਗੇ ਤੁਸੀਂ ਸਾਡੇ ਕੋਲ ਤਾਂ ਭਾਅ ਜੀ ਬਹੁਤ ਤਰੀਕੇ ਦੇ ਹੁੰਦੇ ਹੁਣ ਮੋਡਨ ਕਟਿੰਗ ਆ ਗਈ ਆ ਉਹ 'ਚ ਡਬਲ ਸ਼ੇਡ ਹੋ ਜੂੰਗਾ ਕੈਰਟਨ ਹੋ ਜੂੰਗਾ ਸਮੂਥਨਿੰਗ ਸਟਰੇਟ ਹੋ ਜੂੰਗੇ ਤੁਹਾਡੇ ਬਹੁਤ ਰੀਬੋਡ ਹੋ ਜੂੰਗੇ ਅਲੱਗ ਅਲੱਗ ਤਰੀਕੇ ਦੀ ਹੈਗੇ ਆ ਬਹੁਤ ਸਾਰੇ ਤੁਸੀਂ ਦੱਸੋ ਤੁਹਾਡੇ ਵਾਲ ਕਿੱਦਾਂ ਦੇ ਹੈਗੇ ਆ ਅਤੇ ਭਾਅ ਜੀ ਤੁਸੀਂ ਆਪਣੇ ਵਾਲ ਸਟੇਟ ਕਰਾ ਲਓ ਚਾਹੇ ਕੈਰੇਟਨ ਕਰਾ ਲਓ ਚੋ ਚੋਇਸ ਕਰ ਲਉ ਤੁਸੀਂ ਕਿਆ ਕਿਆ ਕ ਕਰਾਉਣਾ ਕੈਰੇਟਨ 'ਚ ਭਾਅ ਜੀ ਇੱਦਾਂ ਹੁੰਦਾ ਨਾ ਪਹਿਲਾਂ ਤਾਂ ਤੁਹਾਨੂੰ ਆਪਾਂ ਕੈਰੇਟਨ ਕ੍ਰੀਮ ਲਾਉਂਗੇ ਉਹਦੇ ਨਾਲ ਤੁਹਾਡੇ ਵਾਲ ਮਜਬੂਤ ਹੋ ਜਾਂਦੇ ਆ ਅਤੇ ਸ਼ਾਈਨੀ ਹੋ ਜਾਂਦੇ ਆ ਉਹ ਆਪਾਂ ਕਰੀਮ ਪੰਦਰਾਂ ਤੋਂ ਵੀਹ ਮਿੰਟ ਤੱਕ ਅਪਲਾਈ ਕਰਕੇ ਰੱਖਣਾ ਉਹ ਤੋਂ ਬਾਅਦ ਵੋਸ਼ ਕਰਕੇ ਫਿਰ ਆਪਾਂ ਤੁਹਾਡੇ ਵਾਲਾਂ ਨੂੰ ਦਉਂਗੇ ਸਪਾ ਅੱਧੇ ਘੰਟੇ ਦਾ ਫਿਰ ਕੰਪਲੀਟ ਹੋ ਜਾਂਦਾ ਅਤੇ ਇਹਨਾਂ ਦਾ ਅਸਰ ਤੁਹਾਡੇ ਕੋਲ ਰਹਿੰਦਾ ਉਹ ਹੀ ਦੋ ਤੋਂ ਢਾਈ ਮਹੀਨੇ ਤੱਕ ਅਸਰ ਰਹੁੰਗਾ ਤੁਹਾਡੇ ਕੋਲ ਅਤੇ ਇਹਦੀ ਕੇਅਰ ਤੁਹਾਨੂੰ ਕਰਨੀ ਪੈਣੀ ਆਪਣੇ ਵਾਲਾਂ ਦੀ ਡੇਲੀ ਸ਼ੈਪੂ ਲਾ ਕੇ ਧੋਣਾ ਪੈਣਾ ਇੱਦਾਂ

ਪ੍ਰਾਈਜ਼ ਭਾਅ ਜੀ ਜੇ ਬਿਨਾਂ ਸਪਾ ਤੋਂ ਕਰਾਉਂਗੇ ਤਾਂ ਪੰਜ ਸੌ ਰੁਪਇਆ ਸਪਾ ਦੇ ਨਾਲ ਨੌ ਸੌ ਰੁਪਇਆ ਹਾਂਜੀ ਸੰਡੇ ਨੂੰ ਭਾਅ ਜੀ ਖੁੱਲ੍ਹੀ ਹੋਣੀ ਦੁਕਾਨ ਤੁਸੀਂ ਕਿੰਨੇ ਕੁ ਵਜੇ ਤੱਕ ਆਉਣਾ ਮੈਨੂੰ ਟਾਈਮ ਦੱਸ ਦਿਓ ਗਿਆਰਾਂ ਬਾਰਾਂ ਵਜੇ ਤੱਕ ਠੀਕ ਹੈ ਭਾਅ ਜੀ ਤੁਸੀਂ ਆਉਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰ ਦਿਓ ਠੀਕ ਹੈ ਭਾਅ ਜੀ ਆਹ ਨੰਬਰ 'ਤੇ ਮੈਂ ਵੱਟਸਐਪ 'ਤੇ ਸੈਂਡ ਕਰ ਦਿੰਦਾ ਆਪਣੀ ਲੋਕੇਸ਼ਨ ਓਕੇ ਭਾਅ ਜੀ ਤੁਸੀਂ ਫੋਨ ਕਰ ਦਿਓ ਵੈਸੇ ਤਾਂ ਸਾਡੀ ਦੁਕਾਨ ਨਵਾਂ ਸ਼ਹਿਰ ਜਿਲ੍ਹੇ ਦੇ ਵਿੱਚ ਹੈ ਐੱਸ ਬੀ ਐੱਸ ਨਗਰ ਦੇ ਵਿੱਚ ਤੁਸੀਂ ਆਉਣ ਤੋਂ ਪਹਿਲਾਂ ਮੇਰੇ ਇਸੇ ਨੰਬਰ 'ਤੇ ਕਾਲ ਕਰ ਦਿਓ ਓਕੇ ਭਾਅ ਜੀ ਓਕੇ ਭਾਅ ਜੀ ਚੰਗਾ ਜੀ